ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਨਹੀਂ ਜੀ ਦੀਦੀ ਦੀ ਸਿਸਟਰ ਬੋਲਦੇ ਹੋ ਮੈਂ ਪਛਾਣ ਲਿਆ ਪਛਾਣ ਲਿਆ ਅੱਛਾ ਮੈਰਿਜ਼ ਹੋ ਗਈ ਉਹਨਾਂ ਦੀ ਜੋਬ ਵਗੈਰਾ ਹਜੇ ਉਨ੍ਹਾਂ ਨੂੰ ਜੋਬ ਨਹੀਂ ਮਿਲੀ ਨਾਲ਼ੇ ਉਹ ਜੋਬ ਦਾ ਵੀ ਟਰਾਈ ਕਰਦੇ ਸੀ ਓਕੇ ਓਕੇ ਉਹਨਾਂ ਨੇ ਦਿੱਤਾ ਹੋਣਾ ਨਾ ਤੁਹਾਨੂੰ ਫਿਰ ਮੇਰਾ ਨੰਬਰ ਅੱਛਾ ਕੋਈ ਜ਼ਰੂਰੀ ਕੰਮ ਸੀ ਅੱਛਾ ਜੀ ਠੀਕ ਹੈ ਤੁਸੀਂ ਹਾਂਜੀ ਦੇਖੋ ਉਰੇ ਗਰਮੀਆਂ 'ਚ ਤਾਂ ਗਰਮੀ ਬਹੁਤ ਹੁੰਦੀ ਹੈ ਅਤੇ ਤੁਸੀਂ ਗਰਮੀਆਂ ਵਾਲੇ ਹੀ ਕੱਪੜੇ ਲੈ ਆਇਓ ਆਪਣੇ ਨਾਲ਼ ਜਿਵੇਂ ਲੋਰ ਟੀ ਸ਼ਰਟ ਹੋ ਗਿਆ ਹੈ ਨਾ ਹਲਕੇ ਫੁਲਕੇ ਜਿਹੇ ਅਤੇ ਇੱਥੇ ਮੱਛਰ ਵਗੈਰਾ ਬਹੁਤ ਹੁੰਦੇ ਤੁਸੀਂ ਆਪਣਾ ਓਡੋਮੌਸ ਵਗੈਰਾ ਨਾਲ਼ ਲਿਆਇਓ ਅਤੇ ਮੱਛਰਦਾਨੀ ਵੀ ਅਤੇ ਸਰਦੀਆਂ ਵਿੱਚ ਤਾਂ ਇੱਥੇ ਬਹੁਤ ਸਾਰੀ ਸਰਦੀ ਹੁੰਦੀ ਹੈ ਅਤੇ ਉੱਥੇ ਤੁਸੀਂ ਪੂਰੇ ਆਪਣੇ ਗਰਮੀਆਂ ਵਾਲੇ ਹੀ ਕੱਪੜੇ ਲੈ ਕੇ ਆਉਣੇ ਹੈ ਜਿਵੇਂ ਕਿ ਜੈਕਟ ਵਗੈਰਾ ਹੋ ਗਏ ਜੈਕਟਾਂ ਹੋ ਗਈਆਂ ਹੈ ਨਾ ਅਤੇ ਉਹ ਹੁੰਦੇ ਨਾ ਜ ਜਿਹੜੇ ਕੰਬਲ ਵਗੈਰਾ ਵਾਲੇ ਲੋਰ ਟੀ ਸ਼ਰਟ ਆਉਂਦੇ ਹੁੰਦੇ ਆ ਨਾ ਉਹ ਵਾਲ਼ੇ ਲੈ ਆਇਓ ਅਤੇ ਤੁਸੀਂ ਆਪਣੇ ਕੰਬਲ ਵਗੈਰਾ ਵੀ ਪੈਕ ਕਰਵਾ ਲਿਆਇਓ ਨਾਲ਼ ਅਤੇ ਸਰਦੀਆਂ ਵਿੱਚ ਤਾਂ ਇੱਥੇ ਸ਼ੂਜ਼ ਵਗੈਰਾ ਹੀ ਪੈਂਦੇ ਐਂ ਕਿਉਂਕਿ ਠੰਡ ਹੁੰਦੀ ਹੈ ਅਤੇ ਗਰਮੀਆਂ ਵਿੱਚ ਤਾਂ ਉਹੀ ਸੈਂਡਲ ਏ ਪਾ ਸਕਦੇ ਹਾਂ ਆਪਾਂ ਸੈਂਡਲ ਹੋਗੇ ਸਲੀਪਰਸ ਵਗੈਰਾ ਚੱਲ ਸਕਦੇ ਐਂ ਤੁਸੀਂ ਵੈਸੇ ਕਰਨਾ ਕਿ ਕਿਆ ਏ ਅੱਛਾ ਤੁਸੀਂ ਬੀ ਏ ਕਰਨੀ ਸੀ ਠੀਕ ਹੈ ਠੀਕ ਵੈਸੇ ਹੈ ਗਰਮੀਆਂ 'ਚ ਤਾਂ ਹੁੰਦੀ ਦੇਖੋ ਇੱਥੇ ਗਰਮੀ ਓ ਹੈ ਪਰ ਇੱਥੇ ਨਾ ਬਿਮਾਰੀਆਂ ਜਿਵੇਂ ਕਿ ਮਲੇਰੀਆ ਡੇਂਗੂ ਵਗੈਰਾ ਬਹੁਤ ਚੱਲਦਾ ਇਸ ਲਈ ਨਾ ਤੁਸੀਂ ਆਪਣੀ ਓਡੋਮੋਸ ਵਗੈਰਾ ਨਾਲ਼ ਲੈ ਕੇ ਆਇਓ ਅਤੇ ਆਪਣੀ ਹੋਰ ਵੀ ਜੋ ਜ਼ਰੂਰੀ ਸਮਾਨ ਆਪਣਾ ਲੈ ਆਇਓ ਨਾਲ਼ ਹੋਰ ਬਾਕੀ ਜੇ ਤੁਹਾਨੂੰ ਕੁਝ ਚਾਹੀਦਾ ਹੋਇਆ ਤੁਸੀਂ ਸਾਡੇ ਕੋਲੇ ਆਉਣਾ ਏ ਤਾਂ ਅਸੀਂ ਦੇਖ ਲਵਾਂਗੇ ਸਾਤੋਂ ਲੈ ਲਿਓ ਅਸੀਂ ਤੁਹਾਨੂੰ ਦੇ ਦਵਾਂਗੇ ਹਾਂਜੀ ਓਕੇ ਓਕੇ ਬਾਏ